ਮੌਜੂਦਾ ਦ੍ਰਿਸ਼ ਵਿੱਚ ਵਿਗਿਆਪਨ ਅਤੇ ਵਧੇਰੇ ਲੋਕਾਂ ਤੱਕ ਪਹੁੰਚਾਉਣ ਦੇ ਕੁੱਝ ਤਰੀਕੇ ਹਨ ਕਿ ਵਿਗਿਆਪਨ ਜਿਵੇਂ ਇੰਟਰਨੈੱਟ ਹੋ ਗਿਆ ਫ਼ੋਨ ਹੋ ਗਿਆ ਟੀ ਵੀ ਹੋ ਗਿਆ ਨਿਊਜ਼ ਪੇਪਰ ਹੋ ਗਿਆ ਅਖ਼ਬਾਰ ਅਤੇ ਇਤਿਹਾਸ ਜੋ ਪੋਸਟਰ ਲਗਾਏ ਜਾਂਦੇ ਹਨ ਕਿਸੇ ਵਿਗਿਆਪਨਾਂ ਰਾਹੀਂ ਜੋ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਲਗਾਏ ਜਾਂਦੇ ਹਨ ਬੜੇ ਬੜੇ ਪੋਸਟਰਾਂ ਰਾਹੀਂ ਛੋਟੇ ਛੋਟੇ ਪੋਸਟਰਾਂ ਰਾਹੀਂ ਨਿਊਜ਼ ਪੇਪਰਾਂ ਰਾਹੀਂ ਅਖਬਾਰਾਂ ਰਾਹੀਂ ਟੀ ਵੀ ਰਾਹੀਂ ਇੰਟਰਨੈੱਟ ਰਾਹੀਂ ਫ਼ੋਨ ਰਾਹੀਂ ਸਾਨੂੰ ਵਿਗਿਆਪਨ ਬਾਰੇ ਵਧੇਰੀ ਜਾਣਕਾਰੀ ਮਿਲਦੀ ਹੈ ਅਤੇ ਬਹੁਤ ਸਾਰਾ ਸਾਡੇ ਜ਼ਿੰਦਗੀ 'ਤੇ ਪ੍ਰਭਾਵ ਪਾਉਂਦੇ ਹਨ ਸਾਨੂੰ ਪਹੁੰਚਣ ਦੇ ਤਰੀਕੇ ਪ੍ਰਾਪਤ ਹੁੰਦੇ ਹਨ ਜਿਹਨਾਂ ਤੋਂ ਅਸੀਂ ਜਾਣੂ ਨਹੀਂ ਹੁੰਦੇ ਉਹਨਾਂ ਤੋਂ ਅਸੀਂ ਜਾਣੂ ਹੁੰਦੇ ਹਾਂ ਕਿ ਕਿਸ ਚੀਜ਼ ਕਿਸ ਚੀਜ਼ ਬਾਰੇ ਜਿਸ ਚੀਜ਼ ਬਾਰੇ ਸਾਨੂੰ ਨਹੀਂ ਪਤਾ ਵਿਗਿਆ ਉਸ ਉਸ ਚੀਜ਼ ਬਾਰੇ ਸਾਨੂੰ ਵਿਗਿਆਪਨ ਜਾਣੂ ਕਰਾਉਂਦਾ ਹੈ ਉਸ ਤੋਂ ਅਸੀਂ ਜਾਣੂ ਹੋ ਕੇ ਅਸੀਂ ਉਸ ਚੀਜ਼ ਤੱਕ ਪਹੁੰਚਦੇ ਹਾਂ ਜਿਸ ਚੀਜ਼ ਤੋਂ ਜਿਸ ਚੀਜ਼ ਤੱਕ ਅਸੀਂ ਨਹੀਂ ਪਹੁੰਚ ਪਾਉਂਦੇ ਇਹਨਾਂ ਵਿਗਿਆਪਨਾਂ ਨੇ ਸਾਡੀ ਜ਼ਿੰਦਗੀ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਹੈ ਬਹੁਤ ਜ਼ਿਆਦਾ ਸਾਨੂੰ ਹੈਲ ਮਦਦ ਕਰਦੇ ਹਨ ਇਹ ਇਹ ਵਿਗਿਆਪਨ ਕਿਸੇ ਡਾਕਟਰ ਬਾਰੇ ਕਿਸੇ ਕੋਲੇਜ ਬਾਰੇ ਕਿਸੇ ਹੋਰ ਚੀਜ਼ਾਂ ਬਾਰੇ ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਸਾਡੀ ਅਸੀਂ ਜਿਨ੍ਹਾਂ ਜਿੰਦ ਜਿਨ੍ਹਾਂ ਚੀਜ਼ਾਂ ਤੁਸੀਂ ਜਾਣੂ ਨਹੀਂ ਹੁੰਦੇ ਉਹਨਾਂ ਚੀਜ਼ਾਂ ਤੋਂ ਸਾਨੂੰ ਜਾਣੂ ਕਰਵਾਇਆ ਜਾਂਦਾ ਹੈ ਕਿ ਕਿਸ ਚੀਜ਼ ਦਾ ਕਿਆ ਮਤਲਬ ਹੈ ਕਿ ਸਾਡੀ ਜ਼ਿੰਦਗੀ ਵਿੱਚ ਉਸਦਾ ਰੋਲ ਹੈ ਕਿਆ ਅਸੀਂ ਉਸ ਚੀਜ਼ ਨੂੰ ਕਿੱਦਾਂ ਅਸੀਂ ਉਸ ਚੀਜ਼ ਦੀ ਵਰਤੋਂ ਕਰ ਸਕਦੇ ਹਾਂ ਜਿਸ ਚੀਜ਼ ਦੀ ਬਾਰੇ ਸਾਨੂੰ ਨਹੀਂ ਪਤਾ ਹੁੰਦਾ ਇਹ ਵਿਗਿਆਪਨ ਸਾਨੂੰ ਉਹਨਾਂ ਚੀਜ਼ਾਂ ਤੋਂ ਜਾਣੂ ਕਰਵਾਉਂਦੇ ਹਨ ਖ਼ਬਰਾਂ ਰੋਜ਼ਮਰਾ ਦੀਆਂ ਜ਼ਿੰਦਗੀ ਦੀਆਂ ਖ਼ਬਰਾਂ ਤੋਂ ਅਸੀਂ ਜਾਣੂ ਹੁੰਦੇ ਹਾਂ ਇਹਨਾਂ ਵਿਗਿਆਪਨਾਂ ਰਾਹੀਂ ਲ ਅਤੇ ਉਹ ਵਿਗਿਆਪਨ ਸਾਨੂੰ ਬਹੁਤ ਜ਼ਿਆਦਾ ਜ਼ਿੰਦਗੀ ਵਿੱਚ ਮਦਦ ਕਰਦੇ ਹਨ ਜਿਹਨਾਂ ਚੀਜ਼ਾਂ ਬਾਰੇ ਅਸੀਂ ਜਾਣੂ ਨਹੀਂ ਹੁੰਦੇ ਉਹਨਾਂ ਤੋਂ ਜਾਣੂ ਕਰਵਾਉਂਦੇ ਹਨ ਬਹੁਤ ਜ਼ਿਆਦਾ ਮੌਜੂਦਾ ਦ੍ਰਿਸ਼ ਹੈ ਯੇ ਇਹ ਵਿਗਿਆਪਨ ਜਿਹੜਾ ਮੌਜੂਦਾ ਦ੍ਰਿਸ਼ ਵਿਗਿਆਪਨ ਹੈ ਇਹ ਲੋਕਾਂ ਤੱਕ ਪਹੁੰਚਣ ਦਾ ਇੱਕ ਬਹੁਤ ਹੀ ਵਧੀਆ ਜ਼ਰੀਆ ਹੈ ਇਹ ਇਸ ਨਾਲ ਸਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਇਸ ਚੀਜ਼ ਨਾਲ ਅਸੀਂ ਉਹ ਜਿਹੜੀਆਂ ਚੀਜ਼ਾਂ ਤੋਂ ਅਸੀਂ ਜਾਣੂ ਨਹੀਂ ਹੁੰਦੇ ਅੱਗੇ ਤੋਂ ਅੱਗੇ ਅਸੀਂ ਉਹਨਾਂ ਚੀਜ਼ਾਂ ਤੋਂ ਜਾਣੂ ਕਰਵਾਉਦੇ ਹਾਂ ਜਿਸ ਤਰ੍ਹਾਂ ਸਾਨੂੰ ਜਿਸ ਚੀਜ਼ ਦਾ ਵਿਗਿਆਪਨ ਸਾਨੂੰ ਪ੍ਰਾਪਤ ਹੁੰਦਾ ਸੀ ਉਸ ਚੀਜ਼ ਨੂੰ ਅੱਗੇ ਪਹੁੰਚਾਉਂਦੇ ਹਾਂ ਜਿੱਦਾਂ ਕਿ ਇੰਟਰਨੈੱਟ ਰਾਹੀਂ ਵਟਸਐੱਪ ਰਾਹੀਂ ਇੰਸਟਾਗ੍ਰਾਮ ਰਾਹੀਂ ਫੇਸਬੁੱਕ ਰਾਹੀਂ ਅਸੀਂ ਉਹਨਾਂ ਵਿਗਿਆਪਨਾਂ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਹਾਂ ਅਤੇ ਉਹਨਾਂ ਲੋਕ ਉਹ ਲੋਕ ਵੀ ਅੱਗੇ ਤੋਂ ਅੱਗੇ ਉਹਨਾਂ ਚੀਜ਼ਾਂ ਤੋਂ ਜਾਣੂ ਹੁੰਦੇ ਹਨ ਅਤੇ ਉਹਨਾਂ ਚੀਜ਼ਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ ਇਹ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਹਨ ਇਹਨਾਂ ਵਿਗਿਆਪਨਾਂ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਪ੍ਰਭਾਵ ਹੈ ਇਹ ਕਿ ਵਿਗਿਆਪਨਾਂ ਰਾਹੀਂ ਅਸੀਂ ਬਹੁਤ ਜ਼ਿਆਦਾ ਅੱਗੇ ਤੋਂ ਅੱਗੇ ਆ ਪਹੁੰਚ ਸਕਦੇ ਹਾਂ